ਹੈਲੋ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਹਾਂਜੀ ਸਾਡੇ ਇੱਥੇ ਜੀ ਕੁਲਚੇ ਛੋਲੇ ਜਿਹੜੇ ਕਿ ਉਹ ਬਹੁਤ ਜ਼ਿਆਦਾ ਫੇਮਸ ਹੈ ਤੁਸੀਂ ਉਹਦਾ ਬਲੋਗ ਬਣਾ ਸਕਦੇ ਹੋ ਇਹ ਸਟਰੀਟ ਫੂਡ ਹੁੰਦਾ ਹੈ ਜਿਹੜਾ ਕਿ ਜਿੱਦਾਂ ਗੋਲਗੱਪੇ ਆਪਣੇ ਹੋ ਗਏ ਅਤੇ ਇੱਥੇ ਨਾ ਪੰਜਾਬ ਦਾ ਮਿਕਸ ਕਰਕੇ ਚਾਈਨਜ਼ ਅਤੇ ਪੰਜਾਬ ਫੂਡ ਦਾ ਮਿਕਸ ਜਿਹੜਾ ਮਸਾਲਾ ਹੈ ਉਹ ਕਰਕੇ ਚਾਈਨਜ਼ ਫੂਡ ਜਿਹੜਾ ਜਿੱਦਾਂ ਕਿ ਸਪਰਿੰਗ ਰੋਲ ਵਗੈਰਾ ਹੈ ਇਹ ਸਾਰੇ ਬਣਾਏ ਜਾਂਦੇ ਨੇ ਅਤੇ ਤੁਸੀਂ ਉਹਦਾ ਵੀ ਬਲੋਗ ਕਰ ਸਕਦੇ ਹੋ ਅਤੇ ਇੱਦਾਂ ਦੇ ਬਹੁਤ ਸਾਰੇ ਮਤਲਬ ਉਹ ਹੈਗੇ ਨੇ ਤੁਸੀਂ ਉਹਨਾਂ ਦਾ ਕਰ ਸਕਦੇ ਹੋ ਹਾਂਜੀ ਇੱਥੇ ਪੰਜਾਬ ਦੇ ਬਹੁਤ ਸਾਰੇ ਢਾਬੇ ਨੇ ਜਿਨ੍ਹਾਂ 'ਤੇ ਤੁਸੀਂ ਜਾ ਸਕਦੇ ਹੋ ਬਹੁਤ ਸਾਰੇ ਢਾਬੇ ਨੇ ਕੋਈ ਇੱਕ ਵਧੀਆ ਦੱਸ ਨਹੀਂ ਸਕਦੇ ਤੁਹਾਨੂੰ ਸਾਰੇ ਵਧੀਆ ਨੇ ਤੁਸੀਂ ਕਿਸੇ ਵੀ ਢਾਬੇ 'ਤੇ ਜਾ ਕੇ ਆਪਣਾ ਦੇਖ ਸਕਦੇ ਹੋ ਅਤੇ ਸਟਰੀਟ ਫੂਡ ਤਾਂ ਸਾਰਾ ਹੀ ਵਧੀਆ ਹੁੰਦਾ ਹੈ ਸਭ ਵਧੀਆ ਹੁੰਦਾ ਹੈ ਜੀ ਜੋ ਜਿੱਦਾਂ ਦਾ ਤੁਹਾਡਾ ਟੇਸਟ ਹੈ ਤੁਸੀਂ ਉੱਦਾਂ ਦਾ ਹੀ ਕਹਿ ਸਕਦੇ ਹੋ ਵੀ ਇੱਦਾਂ ਦਾ ਕਰੋ ਤਾਂ ਉਹ ਉੱਦਾਂ ਦਾ ਕਰ ਸਕਦੇ ਹੋ ਤੁਹਾਡੇ ਲਈ ਹਾਂਜੀ ਹਾਂਜੀ ਹਾਂਜੀ ਵਧੀਆ ਹੁੰਦੀਆਂ ਨੇ ਸਾਰੀਆਂ ਹਾਂਜੀ ਕਿੱਦਾਂ ਮਤਲਬ ਦੇਖੋ ਜੀ ਪੰਜਾਬ 'ਤੇ ਤੁਸੀਂ ਜਿੱਥੇ ਮਰਜ਼ੀ ਲੰਘ ਜਾਉ ਖਰੜ ਲੰਘ ਜਾਉ ਮੋਹਾਲੀ ਲੰਘ ਜਾਉ ਬਹੁਤ ਸਾਰੇ ਰੈਸਟੋਰੈਂਟ ਨੇ ਅਤੇ ਢਾਬੇ ਨੇ ਤੁਸੀਂ ਉੱਥੇ ਜਾ ਸਕਦੇ ਹੋ ਉਹਦੇ ਹਿਸਾਬ ਨਾਲ ਹੁੰਦਾ ਹੈ ਜਿੰਨਾ ਤੁਸੀਂ ਖਾਣਾ ਲੈਣਾ ਚਾਹੁੰਦੇ ਹੋ ਜਾਂ ਫਿਰ ਜੋ ਵੀ ਤੁਸੀਂ ਖਾਣਾ ਹੈ ਉਹਦੇ ਹਿਸਾਬ ਨਾਲ ਹੁੰਦਾ ਹੈ ਸਾਰਾ ਪ੍ਰਾਈਜ਼ ਚਲੋ ਜੀ ਠੀਕ ਹੈ ਤੁਸੀਂ ਆ ਸਕਦੇ ਹੋ ਜਦ ਮਰਜ਼ੀ ਹਾਂਜੀ ਓਕੇ